ਰਾਤ ਦਾ ਅਸਮਾਨ ਹਮੇਸ਼ਾਂ ਬਦਲਦਾ ਰਹਿੰਦਾ ਹੈ ਅਤੇ ਜੇਕਰ ਤੁਸੀਂ ਸਵਰਗੀ ਸਰੀਰ ਦੇ ਪ੍ਰੇਮੀ ਹੋ ਤਾਂ ਇੱਥੇ ਭਾਰਤ ਵਿੱਚ ਪਹਿਲੀ ਵਾਰ ਤਾਰੇ ਦੇਖਣ ਦੇ ਅਨੁਭਵ ਲਈ ਸਭ ਤੋਂ ਵਧੀਆ ਸਮਾਂ ਵਧੀਆ ਸਥਾਨ ਅਤੇ ਸੁਝਾਅ ਇਹ ਹੈ ਸਾਲਜ਼ੀ ਇੱਕ ਸ਼ਾਨਦਾਰ ਅਤੇ ਹੈਰਾਨ ਕਰਨ ਵਾਲੀ ਗਤੀਵਿਧੀ ਹੈ ਜੋ ਕਿ ਤੁਹਾਨੂੰ ਰਾਤ ਦੇ ਸਮੇਂ ਅਸਮਾਨ ਦੀ ਸੁੰਦਰਤਾ ਨੂੰ ਵੇਖਣ ਅਤੇ ਉਸਦੀ ਕਦਰ ਕਰਨ ਦੀ ਇਜਾਜ਼ਤ ਦਿੰਦੀ ਹੈ ਪਰ ਆਪਣੇ ਸਟਾਰਗੇਜ਼ਿੰਗ ਅਨੁਭਵ ਨੂੰ ਵੱਧ ਤੋਂ ਵੱਧ ਕਰਨ ਲਈ ਸ਼ਹਿਰ ਦੀਆਂ ਲਾਈਟਾਂ ਅਤੇ ਰੌਸ਼ਨੀ ਪ੍ਰਦੂਸ਼ਣ ਤੋਂ ਦੂਰ ਸਥਾਨ ਲੱਭੋ ਅਜਿਹਾ ਸਥਾਨ ਜਿੱਥੇ ਸਾਨੂੰ ਤਾਰੇ ਬਿਲਕੁਲ ਸਾਫ਼ ਸੁਥਰੇ ਦਿਖਾਈ ਦੇਣ ਅਸਮਾਨ ਜਿੰਨਾਂ ਗੂੜਾ ਹੋਵੇਗਾ ਉੱਨੇ ਹੀ ਤਾਰੇ ਤੁਹਾਨੂੰ ਸਹੀ ਅਤੇ ਕਲੀਅਰ ਦਿਖਣਗੇ ਤੁਸੀਂ ਉੱਨੇ ਹੀ ਜ਼ਿਆਦਾ ਤਾਰੇ ਅਤੇ ਆਕਾਸ਼ੀ ਵਸਤੂਆਂ ਨੂੰ ਦੇਖ ਸਕੋਗੇ ਇਹ ਇੱਕ ਸ਼ਾਂਤ ਅਤੇ ਮੰਨਣ ਕਰਨ ਵਾਲੀ ਗਤੀਵਿਧੀ ਹੈ ਇਸ ਲਈ ਆਪਣੇ ਆਪ ਨੂੰ ਆਰਾਮ ਨਾਲ ਧੀਰਜ ਰੱਖੋ ਅਤੇ ਆਪਣੀਆਂ ਅੱਖਾਂ ਨੂੰ ਹਨੇਰੇ ਵਿੱਚ ਅਨੁਕੂਲ ਹੋਣ ਦਿਓ ਕਿਉਂਕਿ ਤੁਹਾਡੀਆਂ ਅੱਖਾਂ ਨੂੰ ਘੱਟ ਰੌਸ਼ਨੀ ਦੀਆਂ ਸਥਿਤੀਆਂ ਦੇ ਅਨੁਕੂਲ ਹੋਣ ਵਿੱਚ ਸਮਾਂ ਲੱਗਦਾ ਹੈ ਇਸ ਲਈ ਤਾਰਾ ਦੇਖਣ ਤੋਂ ਪਹਿਲਾਂ ਚਮਕਦਾਰ ਰੌਸ਼ਨੀ ਜਾਂ ਸਕਰੀਨਾਂ ਨੂੰ ਨਾ ਦੇਖੋ ਜਿੱਦਾਂ ਕਿ ਸਾਨੂੰ ਪਤਾ ਹੈ ਕਿ ਤਾਰਿਆਂ ਨੂੰ ਦੇਖਣ ਤੋਂ ਪਹਿਲਾਂ ਸਾਨੂੰ ਕੋਈ ਵੀ ਲਾਈਟ ਵਾਲੀ ਚੀਜ਼ ਰੌਸ਼ਨੀ ਨਹੀਂ ਦੇਖਣ ਸਾ ਦੇਖਣੀ ਚਾਹੀਦੀ ਕਿਉਂਕਿ ਇਸਦਾ ਇਹ ਵੀ ਕਾਰਨ ਹੈ ਕਿ ਤਾਰਿਆਂ ਦਾ ਗ੍ਰਹਿ ਬਹੁਤ ਹੀ ਸ਼ਾਂਤ ਅਤੇ ਚਮਕੀਲਾ ਹੁੰਦਾ ਹੈ ਜਿਸ ਦੇ ਕਾਰਨ ਸਾਨੂੰ ਤਾਰਾ ਅਤੇ ਉਸਦੀ ਰੌਸ਼ਨੀ ਦੇਖਣ ਵਿੱਚ ਬਹੁਤ ਮੁਸ਼ਕਿਲ ਆਉਂਦੀ ਹੈ